ਦੇਖੋ ਘਰ ਦੇ ਵਿੱਚ ਸਭ ਤੋਂ ਵਧੀਆ ਲੱਗਣ ਚੀਜ਼ ਵਾਲ਼ੀ ਮੈਨੂੰ ਉਹ ਚੀਜ਼ ਲੱਗਦੀ ਹੈ ਜੋ ਕਿ ਡਾਇਨਿੰਗ ਟੇਬਲ ਹੈ ਇਸ ਦੇ ਵਿੱਚ ਸਾਰਾ ਪਰਿਵਾਰ ਇੱਕ ਸਾਥ ਇਕੱਠਾ ਬੈਠ ਕੇ ਖਾਣਾ ਖਾਂਦਾ ਏ ਸਵੇਰੇ ਇਕੱਠਾ ਹੁੰਦਾ ਏ ਅਤੇ ਸ਼ਾਮ ਨੂੰ ਵੀ ਇਕੱਠਾ ਹੁੰਦਾ ਏ ਇਸ ਨਾਲ ਸਵੇਰੇ ਪਰਿਵਾਰ ਦੇ ਸਾਰੇ ਦੁੱਖ ਸੁੱਖ ਸਾਂਝੇ ਕਰ ਲੈਂਦੇ ਹਨ ਅਤੇ ਸਾਰਾ ਪਰਿਵਾਰ ਗੱਲਾਂ ਮਾਰਦਾ ਏ ਅਤੇ ਆਪਣੀਆਂ ਤਾਜੀਆਂ ਗੱਲਾਂ ਸਾਂਝੀਆਂ ਕਰਦਾ ਏ ਅਤੇ ਇਸ ਨਾਲ਼ ਸਾਰਾ ਪਰਿਵਾਰ ਹੱਸਦਾ ਏ ਜਿਸ ਨਾਲ ਸਿਹਤ ਵੀ ਵਧੀਆ ਰਹਿੰਦੀ ਹੈ ਅਤੇ ਪਰਿਵਾਰ ਦੀ ਰੌਣਕ ਵੀ ਵੱਧ ਜਾਂਦੀ ਹੈ ਜੀ ਧੰਨਵਾਦ